ਹੈਲੋ ਵਧੀਆ ਵਧੀਆ ਤੁਸੀਂ ਦੱਸੋ ਹੋਰ ਕੀ ਕਰਦੇ ਅੱਛਾ ਉਹ ਨਾਲੇ ਮੁਬਾਰਕਾਂ ਆਪਣੇ ਦੋਨਾਂ ਦੇ ਬਹੁਤ ਵਧੀਆ ਨੰਬਰ ਆ ਗਏ ਹਾਂ ਬਸ ਇੱਦਾਂ ਹੀ ਘਰ ਦੇ ਕਹਿੰਦੇ ਸੀ ਵੀ ਆਪਣੇ ਨਾਲ ਦੀਆਂ ਨਾਲ ਡਿਸਕਸ ਕਰ ਲਾ ਕਿੱਥੇ ਲੱਗਣਾ ਮੈਂ ਕਿਹਾ ਚੱਲ ਤੈਨੂੰ ਪੁੱਛ ਲੈਂਦੀ ਹਾਂ ਤੁਸੀਂ ਦੱਸੋ ਪਹਿਲਾਂ ਕਿੱਥੇ ਲੱਗਣਾ ਮੈਂ ਤਾਂ ਸੋਚਿਆ ਪੰਜਾਬੀ ਯੂਨੀਵਰਸਿਟੀ ਠੀਕ ਆ ਪਟਿਆਲੇ ਨੇੜੇ ਹੀ ਆ ਪਰ ਮੈਨੂੰ ਪੰਜਾਬੀ ਯੂਨੀਵਰਸਿਟੀ ਜ਼ਿਆਦਾ ਵਧੀਆ ਲੱਗਦੀ ਉੱਥੋਂ ਦਾ ਸਟਾਫ ਵਗੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ 'ਚ ਇਹ ਵਧੀਆ ਵੀ ਉਹ ਆਪਾਂ ਨੂੰ ਲੋਕਲ ਪੈ ਜਾਂਦੀ ਹੈ ਅਤੇ ਆਪਾਂ ਨੂੰ ਆਉਣ ਜਾਣ ਦਾ ਘੱਟ ਖਰਚਾ ਹੋਊਗਾ ਹੋਸਟਲ ਵਗੈਰਾ ਨਹੀਂ ਲੈਣਾ ਪਊਗਾ ਪਟਿਆਲੇ ਪੈ ਜਾਂਦੀ ਆ ਇੱਕ ਪੰਜਾਬ ਯੂਨੀਵਰਸਿਟੀ ਆ ਚੰਡੀਗੜ੍ਹ ਉਹਦੇ ਵਾਸਤੇ ਆਪਾਂ ਨੂੰ ਐਂਟਰੈਂਸ ਦੇਣਾ ਪੈਣਾ ਉਹਦੀ ਡੇਟ ਲੰਘ ਗਈ ਹਾਂ ਫਿਰ ਨਹੀਂ ਹੋਸਟਲ ਦੇਖ ਲਵਾਂਗੇ ਉੱਥੋਂ ਦਾ ਖਰਚਾ ਵੀ ਜ਼ਿਆਦਾ ਨਹੀਂ ਹੈਗਾ ਕਿਉਂਕਿ ਉਹ ਸਰਕਾਰੀ ਆ ਜਾਂਦੀ ਆ ਨਾ ਹੋਸਟਲ ਦਾ ਤਾਂ ਘੱਟ ਹੀ ਆਉਂਦਾ ਪੰਜ ਛੇ ਹਜ਼ਾਰ ਹੀ ਆਉਂਦਾ ਇੱਕ ਸਮੈਸਟਰ ਦਾ ਪਹਿਲਾਂ ਤਾਂ ਵੈਸੇ ਆਪਣਾ ਕੋਰਸ ਹੀ ਦੇਖਣਾ ਪੈਣਾ ਆਪਾਂ ਨੇ ਆਪਾਂ ਕਿਹੜਾ ਲੈਣਾ ਹੈ ਨਾ ਫਿਰ ਉਹਦੇ ਹਿਸਾਬ ਨਾਲ ਫੀਸ ਵਗੈਰਾ ਸਾਰਾ ਕੁਛ ਦੱਸਣਗੇ ਉਹ ਘੱਟ ਹੀ ਆਉਂਦਾ ਕਿਉਂਕਿ ਸਰਕਾਰੀ ਹੈ ਨਾ ਇਹ ਬਸ ਨਾਲ ਹੀ ਆਪਣੇ ਪੇਰੈਂਟਸ ਕਿਹੜਾ ਸਰਕਾਰੀ ਜੋਬ ਕਰਦੇ ਨੇ

ਹਾਂ ਇੱਕ ਵਾਰ ਤੁਸੀਂ ਵੀ ਆਪਣੇ ਘਰ ਪੁੱਛ ਲਉ ਮੈਂ ਵੀ ਪੁੱਛ ਲੂੰਗੀ ਓਕੇ ਬਾਏ